ਪੇਂਡੂ ਖੇਤਰਾਂ ਦੀ ਸੱਭਿਆਚਾਰਿਕ ਪਛਾਣ ਨੂੰ ਬਚਾਉਣ ਅਤੇ ਉਤਸ਼ਾਹਿਤ ਕਰਨ ਵਿੱਚ ਰਵਾਇਤੀ ਖੇਡਾਂ ਬਹੁਤ ਹੀ ਵਧੀਆ ਭੂਮਿਕਾ ਨਿਭਾਉਂਦੀਆਂ ਨੇ ਸਾਡੀਆਂ ਰਵਾਇਤੀ ਖੇਡਾਂ ਜਿਵੇਂ ਗੁੱਲੀ ਡੰਡਾ ਖੋ ਖੋ ਕਬੱਡੀ ਕ੍ਰਿਕਟ ਹਾਕੀ ਇਹ ਸਾਡੇ ਪੇਂਡੂ ਖੇਤਰ ਦੀਆਂ ਖੇਡਾਂ ਨੇ ਜਿਨ੍ਹਾਂ ਨੂੰ ਬੱਚੇ ਖੇਡਦੇ ਹੋਏ ਨਾਲ ਤਾਂ ਸਰੀਰਕ ਰੂਪ ਵਿੱਚ ਤੰਦਰੁਸਤ ਰਹਿੰਦੇ ਨੇ ਅਤੇ ਨਾਲ ਉਹਨਾਂ ਦੀ ਆਪਸੀ ਪਿਆਰ ਸਾਂਝ ਮਜ਼ਬੂਤੀ ਬਣਦੀ ਹੈ ਖੇਡਾਂ ਦੁਆਰਾ ਹੀ ਉਹਨਾਂ ਦਾ ਜਿਹੜਾ ਪੰਜਾਬ ਲੈਵਲ 'ਤੇ ਨਾਂ ਬਣਦਾ ਹੈ ਦੇਸ਼ ਪੱਧਰ 'ਤੇ ਇੰਟਰਨੈਸ਼ਨਲ ਪੱਧਰ 'ਤੇ ਆਪਣੇ ਵਿਰਸੇ ਦੀ ਪਹਿਚਾਣ ਹੁੰਦੀ ਇਸ ਕਰਕੇ ਜਿਹੜੀਆਂ ਪੇਂਡੂ ਖੇਤਰ ਦੇ ਦੀਆਂ ਰਵਾਇਤੀ ਖੇਡਾਂ ਨੇ ਨੌਜਵਾਨ ਇਹਨਾਂ ਰਾਹੀਂ ਆਪਣੇ ਵਿਰਸੇ ਦੀ ਪੰਜਾਬੀ ਸੱਭਿਆਚਾਰਕ ਦੀ ਪਹਿਚਾਣ ਨੂੰ ਬਚਾਉਣ ਅਤੇ ਉਤਸ਼ਾਹਿਤ ਕਰਨ ਵਿੱਚ ਬਹੁਤ ਹੀ ਵਧੀਆ ਭੂਮਿਕਾ ਨਿਭਾਉਂਦੀਆਂ ਨੇ ਇਹ ਖੇਡਾਂ ਜਿਹੜੀਆਂ ਨੇ ਇਹ ਸਾਡਾ ਵਿਰਸਾ ਹੈ ਸਾਡੀ ਸ਼ਾਨ ਹੈ ਇਸ ਕਰਕੇ ਨੌਜਵਾਨ ਇਹਨਾਂ ਦੁਆਰਾ ਆਪਣੇ ਵਿਰਸੇ ਨੂੰ ਪ੍ਰਫੁਲਿੱਤ ਕਰਦੇ ਨੇ